ਮੇਰੀ ਚਿੱਤਰਕਾਰੀ ਨੂੰ ਬਿਹਤਰ ਬਣਾਉਣ ਲਈ ਮੇਰੇ ਇੱਕ ਅਧਿਆਪਕ ਨੇ ਬਹੁਤ ਮੱਦਦ ਕੀਤੀ ਸੀ ਜਿਵੇਂ ਮੈਨੂੰ ਸਕੈਚ ਜਾਂ ਪਾਣੀ ਵਾਲੇ ਰੰਗਾਂ ਨਾਲ ਚਿੱਤਰਕਾਰੀ ਨਹੀਂ ਸੀ ਬਣਾਉਣੀ ਆਉਂਦੀ ਪਰ ਮੇਰੇ ਅਧਿਆਪਕ ਨੇ ਮੈਨੂੰ ਬੜੀ ਵਧੀਆ ਤਰ੍ਹਾਂ ਸਮਝਾਇਆ ਅਤੇ ਮੈਂ ਆਪਣੀ ਚਿੱਤਰਕਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਕੋਲ ਪੇਸ਼ ਕੀਤਾ ਹਾਂ ਜੀ ਔਨਲਾਈਨ ਵਿੱਚ ਵੀ ਬੜੇ ਚਿੱਤਰ ਪੇਂਟਰ ਵੇਖੇ ਹਨ ਉਹਨਾਂ ਵੱਲੋਂ ਤਿਆਰ ਕੀਤੇ ਚੈਨਲ ਵਿੱਚ ਉਹਨਾਂ ਨੇ ਨਵੀਆਂ ਤਕਨੀਕਾਂ ਨਾਲ ਹੀ ਚਿੱਤਰਕਾਰੀ ਬਾਰੇ ਦੱਸਿਆ ਹੈ ਮੈਂ ਆਪਣਾ ਵੀ ਯੂਟਿਊਬ ਚੈਨਲ ਵੀ ਬਣਾਇਆ ਹੈ ਜਿਸ ਵਿੱਚ ਮੈਂ ਬਹੁਤ ਕੁਛ ਬਣਾਇਆ ਹੈ